ਸੋਲਾਂ ਜਨਵਰੀ ਉੱਨੀ ਸੌ ਇਕਾਸੀ ਤੇਰਾਂ ਫਰਵਰੀ ਦੋ ਹਜ਼ਾਰ ਚੌਵੀ ਇੱਕੀ ਦਸੰਬਰ ਦੋ ਹਜ਼ਾਰ ਅੱਠ ਗਿਆਰਾਂ ਦਿਸੰਬਰ ਦੋ ਹਜ਼ਾਰ ਤੇਰਾਂ ਅਠਾਰਾਂ ਜਨਵਰੀ ਉੱਨੀ ਸੌ ਬਿਆਸੀ